ਕੀ ਹੈਲੋ ਕੀ ਤੁਸੀਂ ਸੋਹਣ ਟਰੈਵਲ ਤੋਂ ਬੋਲਦੇ ਹੋ ਤੁਸੀਂ ਅਸੀਂ ਗੱਡੀ ਬੁੁੱਕ ਕਰਾਈ ਸੀ ਮੈਂ ਗੱ ਡਰਾਈਵਰ ਤੁਹਾਡਾ ਪਹੁੰਚਿਆ ਨਹੀਂ ਅਤੇ ਅਸੀਂ ਪੈਸੇ ਵੀ ਪੂਰੇ ਦਿੱਤੇ ਨੇ ਅਤੇ ਨਾ ਹੀ ਉਹ ਫੋਨ ਚੱਕ ਰਿਹਾ ਨਾ ਹੀ ਗੱਲ ਕਰ ਰਿਹਾ ਨਾ ਹੀ ਵੀ ਅਸੀਂ ਇੱਕ ਦਿਨ ਸਾਡੇ ਕੋਲ ਘੁੰਮਣ ਦਾ ਸੀ ਅਤੇ ਅਸੀਂ ਉਹੀ ਦਿਨ ਸਾਡਾ ਵੇਸਟ ਹੋ ਗਿਆ ਅਤੇ ਅਸੀਂ ਵੀ ਕੀ ਕਰ ਸਕਦੇ ਅਸੀਂ ਸਾਨੂੰ ਪਹਿਲਾਂ ਹੀ ਕਿ ਕਿਸੇ ਨੇ ਕਿਹਾ ਸੀ ਵੀ ਤੁਸੀਂ ਬੁੱਕ ਨਾ ਕਰੋ ਮੈਂ ਫਿਰ ਵੀ ਤੁਹਾਡੇ 'ਤੇ ਵਿਸ਼ਵਾਸ ਕਰ ਲਿਆ ਅਸੀਂ ਕੀ ਕਰ ਸਕਦੇ ਹਾਂ ਵੀ ਇਸ ਕਾਰਨ ਅਸੀਂ ਹੁਣ ਸਾ ਇਹ ਸਾਡਾ ਇੱਕ ਦਿਨ ਵੇਸਟ ਹੋ ਗਿਆ ਅਸੀਂ ਕੀ ਕਰੀਏ ਇੱਕ ਦਿਨ ਸਾਨੂੰ ਮਿਲਿਆ ਸੀ ਉਹ ਵੀ ਸਾਡਾ ਵੇਸਟ ਹੋ ਗਿਆ ਨਾ ਹੀ ਉੱਥੇ ਪਹੁੰਚਿਆ ਡਰਾਈਵਰ ਫੋਨ ਚੱਕ ਰਿਹਾ ਅਤੇ ਨਾ ਹੀ ਪਹੁੰਚਿਆ ਹਾਲੇ ਤੱਕ ਅਸੀਂ ਤੁਹਾਡੇ 'ਤੇ ਵਿਸ਼ਵਾਸ ਕਰਕੇ ਵੀ ਗੱਡੀ ਬੁੱਕ ਕਰਾਈ ਸੀ ਅਤੇ ਹੁਣ ਅਸੀਂ ਕੀ ਕਰ ਸਕਦੇ ਹਾਂ ਦੱਸ ਵੀ ਇਸ ਤਰ੍ਹਾਂ ਥੋੜ੍ਹਾ ਕਿ ਕਰ ਸਕਦੇ ਕਰਦੇ ਨੇ ਬਾਕੀ ਕੀ ਹੁਣ ਅਸੀਂ ਕੀ ਕਰ ਸਕਦੇ ਹਾਂ ਗੱਡੀ ਫਿਰ ਸਾਨੂੰ ਮਿਲ ਨਹੀਂ ਰਹੀ ਟਾਇਮ ਸਿਰ ਇਸ ਕਾਰਨ